ਹੈਲੋ ਹਾਂਜੀ ਤੁਸੀਂ ਸਾਈਕਲਾਂ ਦੀ ਦੁਕਾਨ ਤੋਂ ਬੋਲਣ ਦੇ ਹਾਂਜੀ ਮੈਂ ਨਾ ਆਪਣੀ ਛੋਟੀ ਭੈਣ ਲਈ ਸਾਈਕਲ ਲੈਣਾ ਸੀ ਕੁੜੀਆਂ ਵਾਸਤੇ ਤੁਹਾਡੇ ਤੋਂ ਵਧੀਆ ਸਾਈਕਲ ਮਿਲ ਜਾਣਗੇ ਹਾਂਜੀ ਕਿੰਨੇ ਕੁ ਰੇਟ ਤੱਕ ਦੇ ਮਿਲਣਗੇ ਵਧੀਆ ਸਾਈਕਲ ਵਧੀਆ ਕੁਆਲਟੀ ਹੋਵੇ ਜਿਹਦੀ ਹਾਂਜੀ ਚਾਰ ਹਜ਼ਾਰ ਤੋਂ ਸਟਾਰਟਿੰਗ ਆ ਹਾਂਜੀ ਤਾਂ ਮੈਂ ਕਦੋਂ ਕੁ ਆ ਸਕਦੀ ਹਾਂ ਤੁਹਾਡੇ ਸ਼ੋ ਰੂਮ 'ਤੇ ਹਾਂਜੀ ਠੀਕ ਆ ਵਧੀਆ ਕੁਆਲਟੀ ਦਾ ਚਾਹੀਦਾ ਮੈਨੂੰ ਆਪਣੀ ਭੈਣ ਲਈ ਛੋਟੀ ਆ ਹਜੇ ਉਹ ਹਾਂਜੀ ਠੀਕ ਆ ਕੋਈ ਨਹੀਂ ਕੱਲ੍ਹ ਅਸੀਂ ਜ਼ਰੂਰ ਵੀਜ਼ਿਟ ਕਰਾਂਗੇ ਅਤੇ ਲੈ ਕੇ ਜਾਵਾਂਗੇ ਸਾਈਕਲ ਹਾਂਜੀ ਠੀਕ ਆ ਓਕੇ ਹਾਂਜੀ ਕੋਈ ਨਹੀਂ ਮੈਂ ਆਪਣੀ ਛੋਟੀ ਭੈਣ ਨੂੰ ਨਾਲ ਲੈ ਕੇ ਜਾਊਂਗੀ ਉਹ ਜਿਹੜਾ ਉਹਨੂੰ ਸਾਈਕਲ ਪਸੰਦ ਹੋਵੇ ਉਹ ਲੈ ਲਾਂਗੇ ਸਰ ਹਾਂਜੀ ਓਕੇ ਜੀ